ਜ਼ਰੂਰ ਭਾਰਤ ਦੇ ਸਮੇਂ ਉਦਮੀ ਅਲੀ ਇੱਕ ਬਹੁਤ ਹੀ ਉਤਸ਼ਾਹਜਨਕ ਮਾਹੌਲ ਪੇਸ਼ ਕਰ ਰਿਹਾ ਹੈ ਇਸ ਦੀ ਕਈ ਕਾਰਨ ਹਨ ਡਿਜੀਟਲ ਇਨਕਲਾਬ ਭਾਰਤ ਵਿੱਚ ਇੰਟਰਨੈਟ ਅਤੇ ਸਮਾਰਟਫੋਨ ਦੀ ਪਹੁੰਚ ਤੇਜ਼ੀ ਨਾਲ ਵੱਧ ਰਹੀ ਹੈ ਇਸ ਨਾਲ ਨਵੇਂ ਸਟਾਰਟਅਪਸ ਲਈ ਬਹੁਤ ਸਾਰੇ ਮੌਕੇ ਪੈਦਾ ਹੋ ਰਹੇ ਹਨ ਖਾਸ ਕਰਕੇ ਈ ਕਮਰਸ ਫੀਟੈਕ ਅਤੇ ਐਡਿਟਿਕ ਦੇ ਖੇਤਰਾਂ ਵਿੱਚ ਜਵਾਨ ਆਬਾਦੀ ਭਾਰਤ ਦੀ ਜਵਾਨ ਆਬਾਦੀ ਇੱਕ ਵੱਡਾ ਫਾਇਦਾ ਹੈ ਇਹ ਨਵੇਂ ਵਿਚਾਰਾਂ ਅਤੇ ਤਕਨੀਕਾਂ ਲਈ ਖੁੱਲ੍ਹੇ ਹਨ ਅਤੇ ਉਦਮੀ ਬਣਨ ਲਈ ਉਤਸੁਕ ਹਨ ਸਰਕਾਰੀ ਸਮਰਥਨ ਭਾਰਤ ਸਰਕਾਰ ਨੇ ਸਟਾਰਟਪਸ ਨੂੰ ਵਧਾਵਾ ਦੇਣ ਲਈ ਕਈ ਨੀਤੀਆਂ ਅਤੇ ਪ੍ਰੋਗਰਾਮ ਸ਼ੁਰੂ ਕੀਤੇ ਹਨ ਇਹਨਾਂ ਵਿੱਚ ਸਟਾਰਟਅਪਸ ਇੰਡੀਆ ਇਨਵੈਂਸ਼ਨ ਮੇਕ ਇਨ ਇੰਡੀਅਨ ਅਤੇ ਡਿਜੀਟਲ ਇੰਡੀਆ ਸ਼ਾਮਿਲ ਹਨ ਵਿਦੇਸ਼ੀ ਨਿਵੇਸ਼ ਭਾਰਤ ਵਿੱਚ ਵਿਦੇਸ਼ੀ ਨਿਵੇਸ਼ ਵੀ ਤੇਜ਼ੀ ਨਾਲ ਵੱਧ ਰਿਹਾ ਹੈ ਇਸ ਨਾਲ ਸਟਾਰਟਪਸ ਨੂੰ ਫੀਡਿੰਗ ਮਿਲ ਰਹੀ ਹੈ ਅਤੇ ਉਹ ਵਿਸ਼ਵ ਪੱਧਰ 'ਤੇ ਵੱਧ ਰਹੇ ਹਨ